ਅੱਠ ਫਰਵਰੀ ਉੱਨੀ ਸੌ ਨੱਬੇ ਸੱਤ ਨਵੰਬਰ ਦੋ ਹਜ਼ਾਰ ਇੱਕ ਅਠਾਈ ਨਵੰਬਰ ਦੋ ਹਜ਼ਾਰ ਪੰਜ ਚੌਵੀ ਫਰਵਰੀ ਦੋ ਹਜ਼ਾਰ ਚੌਦਾਂ ਤਿੰਨ ਅਪ੍ਰੈਲ ਦੋ ਹਜ਼ਾਰ ਚੌਵੀ